ਜਦੋਂ ਮੈਂ ਘਰ ਤੋਂ ਬਾਹਰ ਹੁੰਦਾ ਤਾਂ ਘਰ ਦੀ ਨਿਗਰਾਨੀ ਲਈ ਡਿਜੀਟਲ ਕੈਮਰੇ ਜਿਹੜੇ ਹੈਗੇ ਆ ਘਰ ਦੀ ਨਿਗਰਾਨੀ ਕਰਨ ਲਈ ਲਗਾਏ ਹੋਏ ਨੇ ਉਨ੍ਹਾਂ ਕੈਮਰਿਆਂ ਦਾ ਫਾਇਦਾ ਇਹ ਹੈ ਕਿ ਜਦੋਂ ਅਸੀਂ ਫਿਜ਼ੀਕਲੀ ਘਰ ਨਹੀਂ ਹੈਗੇ ਪਰ ਉਹ ਪੂਰੀ ਸਾਡੀ ਗੈਰ ਹਾਜ਼ਰੀ ਵਿੱਚ ਵੀ ਘਰ ਦੀ ਪੂਰੀ ਨਿ ਨਿਗਰਾਨੀ ਕਰਦੇ ਨੇ ਅਤੇ ਉਹ ਪੂਰਾ ਡ ਡਾਟਾ ਜਿਹੜਾ ਹੈਗਾ ਜਾਂ ਪੂਰੇ ਪੂਰਾ ਵਿਵਰਣ ਜਿਹੜਾ ਹੈਗਾ ਉਹ ਰਿਕਾਰਡ ਕਰਕੇ ਸੇਵ ਰੱਖਦੇ ਨੇ ਅਸੀਂ ਕਦੇ ਵੀ ਘਰ ਵਾਪਸ ਆ ਕੇ ਉਸ ਸਾਰੀ ਕੁਝ ਨੂੰ ਵੇਖ ਸਕਦੇ ਹਾਂ ਅਗਰ ਕਿਸੇ ਨੇ ਵੀ ਸਾਡੀ ਗੈਰ ਹਾਜ਼ਰੀ ਵਿੱਚ ਸਾਡੇ ਘਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੁੰਦੀ ਹੈ ਤਾਂ ਉਹਦਾ ਸਾਨੂੰ ਪਤਾ ਲੱਗ ਜਾਂਦਾ ਹੈ ਦੂਜੀ ਗੱਲ ਇਹ ਹੈ ਕਿ ਇਹਦੇ ਲਈ ਤੁਹਾਨੂੰ ਥੋੜ੍ਹੀ ਜਿਹੀ ਪੈਸਿਆਂ ਦੀ ਜੇਬ ਹੌਲੀ ਤਾਂ ਕਰਨੀ ਪੈਂਦੀ ਆ ਅਤੇ ਉਹਦੇ ਲਈ ਅਤੇ ਪਰ ਇਹ ਹੈਗਾ ਕਿ ਅਸੀਂ ਹੋਈ ਚੋਰੀ ਜਾਂ ਹੋਈ ਕਿਸੇ ਵੀ ਇੱਦਾਂ ਦੀ ਵਾਰਦਾਤ ਨੂੰ ਜਦੋਂ ਵੀ ਵਾਪਸ ਆਉਂਦੇ ਹਾਂ ਆ ਕੇ ਉਹਦੇ ਤੋਂ ਉਸ ਬਾਰੇ ਕਾਰਵਾਈ ਕਰ ਸਕਦੇ ਹਾਂ